ਪੰਜਾਬੀ ਭਾਸ਼ਾ ਦਾ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਵੱਡੀ ਭੂਮਿਕਾ ਪੰਜਾਬੀ ਜਿੱਦਾਂ ਸਾਡੀ ਰਾਸ਼ਟਰ ਭਾਸ਼ਾ ਸਾਡੀ ਮਾਤ ਭਾਸ਼ਾ ਹੈ ਤਾਂ ਜਿੱਦਾਂ ਬਚਪਨ ਤੋਂ ਹੀ ਸਕੂਲਾਂ ਦੇ ਵਿੱਚ ਸਕੂਲਾਂ ਤੋਂ ਲੈ ਕੇ ਬਚਪਨ ਦੇ ਵਿੱਚ ਹੀ ਜਿੱਦਾਂ ਘਰ ਤੋਂ ਲੈ ਕੇ ਅਸੀਂ ਬੱਚੇ ਨੂੰ ਪੰਜਾਬੀ ਊੜੇ ਆੜੇ ਤੋਂ ਲੈ ਕੇ ਸਿਖਾਈ ਜਾਂਦੀ ਆ ਸਾਡੇ ਸਾਰੇ ਘ ਘਰਾਂ ਦੇ ਵਿੱਚ ਪਰ ਹੁਣ ਆਪਾਂ ਅੱਜ ਕੱਲ੍ਹ ਦੇਖ ਰਹੇ ਹਾਂ ਜਿਹੜੀ ਨਵੀਂ ਸਿੱਖਿਆ ਪ੍ਰਣਾਲੀ ਆ ਆਪਣੇ ਨਵੇਂ ਜਿਹੜੇ ਪ੍ਰਾਈਵੇਟ ਜਿੰਨੇ ਵੀ ਸਰਕ ਸਕੂਲ ਖੁੱਲ੍ਹ ਰਹੇ ਨੇ ਉੱਥੇ ਜਿਹੜਾ ਕਿ ਮੈਨੂੰ ਲੱਗਦਾ ਅੱਜ ਕੱਲ੍ਹ ਕੀ ਹੋ ਰਿਹਾ ਆਪਾਂ ਦੇਖਾਂਗੇ ਜਿੰਨੇ ਵੀ ਇਹ ਪ੍ਰਾਈਵੇਟ ਸਕੂਲ ਨੇ ਉੱਥੇ ਕੀ ਹੈ ਕਿ ਅੰਗਰੇਜ਼ੀ ਭਾਸ਼ਾ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਅਤੇ ਬੱਚੇ ਜਿਹੜੇ ਹੈਗੇ ਨੇ ਆਪਣੀ ਪੰਜਾਬੀ ਜਿਹੜੀ ਮਾਤ ਭਾਸ਼ਾ ਉਹਦੇ ਨਾਲੋਂ ਕਿਤੇ ਨਾ ਕਿਤੇ ਟੁੱਟ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਆਪਣਾ ਵੀ ਇਹ ਇੱਕ ਦਿਮਾਗੀ ਆਪਾਂ ਕਹਿ ਲਈਏ ਵੀ ਇੱਕ ਮਾਇੰਡਸੈਟ ਬਣ ਗਿਆ ਹੈ ਵੀ ਜਿਹੜੀ ਅੰਗਰੇਜ਼ੀ ਭਾਸ਼ਾ ਵੀ ਜੇ ਤੁਹਾਨੂੰ ਉਹ ਆਉਂਦੀ ਹੋਵੇਗੀ ਫਿਰ ਹੀ ਬੱਚਾ ਕੀ ਹੈ ਜ਼ਿਆਦਾ ਇੱਕ ਆਪਾਂ ਕਹਿ ਦੇਈਏ ਲਾਇਕ ਹੋਵੇਗਾ ਜਾਂ ਇੰਟੈਲੀਜੈਂਟ ਹੋਵੇਗਾ ਹਾਲਾਂਕਿ ਇਦਾਂ ਹੈ ਕੁਛ ਨਹੀਂ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਆਪਾਂ ਨੂੰ ਸਿੱਖਿਆ ਪ੍ਰਣਾਲੀ ਦੇ ਵਿੱਚ ਥੋੜ੍ਹਾ ਜਿਹਾ ਸੁਧਾਰ ਲਿਆਉਣ ਦੀ ਕੋਸ਼ਿਸ਼ ਹੈ ਤਾਂ ਕਿ ਆਪਾਂ ਆਪਣੀ ਜਿਹੜੀ ਪੰਜਾਬੀ ਮਾਤ ਭਾਸ਼ਾ ਉਹਨੂੰ ਥੋੜ੍ਹਾ ਜਿਹਾ ਅੱਗੇ ਲੈ ਕੇ ਜਾ ਸਕੀਏ ਪਰ ਆਪਾਂ ਹੁਣ ਅੱਜ ਕੱਲ੍ਹ ਦੇਖਦੇ ਹਾਂ ਹੁਣ ਬਹੁਤ ਹੀ ਬਹੁਤ ਸਰਕਾਰੀ ਦਫ਼ਤਰਾਂ ਦੇ ਵਿੱਚ ਕਈ ਆਪਣੇ ਹੁਣ ਸਰਕਾਰੀ ਯੂਨੀਵ ਯੂਨੀਵਰਸਿਟੀਆਂ ਹੈਗੀਆਂ ਜਿੱਦਾਂ ਪੰਜਾਬੀ ਯੂਨੀਵਰਸਿਟੀ ਹੈ ਉੱਥੇ ਕੀ ਹੈ ਜਿੰਨੇ ਵੀ ਆਪਣੇ ਸਰਕਾਰੀ ਆਪਾਂ ਫਾਰਮ ਨੇ ਕੋਈ ਵੀ ਡਿਗਰੀ ਦੇ ਵਿੱਚ ਆਪਾਂ ਦਾਖਲਾ ਲੈਣ ਜਾ ਰਹੇ ਹਾਂ ਤਾਂ ਜਿਹੜੇ ਵੀ ਜਿੰਨੇ ਵੀ ਫਾਰਮ ਨੇ ਸਾਰੇ ਪੰਜਾਬੀ ਦੇ ਵਿੱਚ ਹੁੰਦੇ ਆ ਆਪਾਂ ਅੱਜ ਕੱਲ੍ਹ ਜੇ ਦੇਖੀਏ ਕਈ ਸਰਕਾਰੀ ਦਫ਼ਤਰਾਂ ਦੇ ਵਿੱਚ ਫਾਰਮ ਹੈਗੇ ਨੇ ਨਾ ਉਹ ਪੰਜਾਬੀ ਦੇ ਵਿੱਚ ਮਤਲਬ ਹੁਣ ਤੋਂ ਲਾਗੂ ਹੋ ਚੁੱਕੇ ਆ ਤਾਂ ਇਹ ਕਿਤੇ ਨਾ ਕਿਤੇ ਜਿਹੜੀ ਆਪਾਂ ਕਹਿ ਲਈਏ ਵੀ ਅਹਿਮ ਭੂਮਿਕਾ ਨਿਭਾਉਂਦੀ ਆ ਨਿਭਾਉਂਦਾ ਆਪਣੇ ਉਹਦੇ ਵਿੱਚ ਹੁਣ ਜਿੱਦਾਂ ਆਪਣੇ ਕਈ ਆਪਾਂ ਬਜ਼ੁਰਗਾਂ ਦੀ ਗੱਲ ਕਰੀਏ ਉਹ ਕੀ ਆ ਅੰਗਰੇਜ਼ੀ ਨਹੀਂ ਪੜ੍ਹ ਸਕਦੇ ਨਾ ਉਹ ਲਿਖ ਸਕਦੇ ਨੇ ਤਾਂ ਹੁਣ ਕੀ ਹੈ ਵੀ ਉਹ ਜੇ ਪੰਜਾਬੀ ਦੇ ਵਿੱਚ ਆਪਣੇ ਇਹ ਸਾਰੇ ਫਾਰਮ ਹੈਗੇ ਆ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਥੋੜ੍ਹਾ ਮਤਲਬ ਫ਼ਾਇਦਾ ਹੋਇਆ ਇਸ ਇਸ ਚੀਜ਼ ਦੇ ਨਾਲ ਵੀ ਉਹ ਆਪਣੇ ਆਪ ਪੜ੍ਹ ਸਕਦੇ ਨੇ ਲਿਖ ਸਕਦੇ ਨੇ ਤਾਂ ਹੁਣ ਆਪਾਂ ਦੇਖਦੇ ਹੋ ਅ ਅੱਜ ਕੱਲ੍ਹ ਦੇਖਦੇ ਹਾਂ ਆਪਣੀਆਂ ਸੜਕਾਂ ਉੱਥੇ ਵੀ ਜਿਹੜੇ ਹੁਣ ਅੱਜ ਕੱਲ੍ਹ ਸਾਈਨ ਬੋਰਡ ਲੱਗੇ ਆ ਪੰਜਾਬੀ 'ਚ ਲਗਾ ਦਿੱਤੇ ਆ ਹੁਣ ਆਪਾਂ ਕਿਸੇ ਵੀ ਬ ਰੈਸਟੋਰੈਂਟ ਦੇ ਬਾਹਰ ਚੱਲ ਜਾਈਏ ਜਾਂ ਮਤਲਬ ਦੇਖੀਏ ਆਪਾਂ ਦੁਕਾਨਾਂ ਦੇ ਬਾਹਰ ਤਾਂ ਉਹ ਜਿਹੜੇ ਬੋਰਡ ਲੱਗੇ ਹੁੰਦੇ ਨੇ ਪਹਿਲਾਂ ਆਪਾਂ ਦੇਖਦੇ ਸੀ ਵੀ ਸਾਰੇ ਅੰਗਰੇਜ਼ੀ ਦੇ ਵਿੱਚ ਹੁਣ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜਾ ਆਪਣਾ ਰੁਝਾਨ ਹੈਗਾ ਨਾ ਉਹ ਥੋੜ੍ਹਾ ਜਿਹਾ ਵੱਧ ਰਿਹਾ ਮਤਲਬ ਪੰਜਾਬੀ ਭਾਸ਼ਾ ਵੱਲ ਹੁਣ ਆਪਾਂ ਮਤਲਬ ਦੇਖਦੇ ਹਾਂ ਵੀ ਜਿਹੜੇ ਬੋਰਡ ਏ ਲੱਗੇ ਹੁੰਦੇ ਆ ਲੋਕ ਪੰਜਾਬੀ 'ਚ ਲਗਾ ਰਹੇ ਨੇ ਆਪਣੇ ਘਰਾਂ ਦੇ ਬਾਹਰ ਨੇਮ ਪਲੇਟ ਲੱਗੀਆਂ ਹੁੰਦੀਆਂ ਨੇ ਉਹ ਤੁਸੀਂ ਦੇਖੋਂਗੇ ਜ ਵੱਧ ਤੋਂ ਵੱਧ ਮੈਨੂੰ ਲੱਗਦਾ ਜਿੰਨੇ ਮੈਂ ਦੇਖੀਆਂ ਨੇ ਉਹ ਸਾਰੀਆਂ ਅੰਗਰੇਜ਼ੀ ਦੇ ਵਿੱਚ ਲਗਾਈਆਂ ਹੋਈਆਂ ਨੇ ਨੇਮ ਪਲੇਟਸ ਤਾਂ ਹੁਣ ਕਿਤੇ ਨਾ ਕਿਤੇ ਕੀ ਆ ਵੀ ਕਈ ਲੋਕ ਇਹ ਕੋਸ਼ਿਸ਼ ਕਰ ਰਹੇ ਨੇ ਵੀ ਮਤਲਬ ਪੰਜਾਬੀ ਦੇ ਵਿੱਚ ਜਿਹੜੀਆਂ ਉਹ ਨੇਮ ਪਲੇਟਸ ਹੈਗੀਆਂ ਜਿਹੜੀਆਂ ਹੋਣ ਤਾਂ ਕਰਕੇ ਕਿਤੇ ਨਾ ਕਿਤੇ ਇਹ ਸਾਰਾ ਜਿਹੜੀਆਂ ਚੀਜ਼ਾਂ ਇਹ ਸਾਰੀਆਂ ਗੱਲਾਂ ਨੇ ਨਾ ਇੱਕ ਜਿਹੜਾ ਬਚਪਨ ਮਤਲਬ ਆਪਣਾ ਜਿਹੜਾ ਬਚਪਨ ਅਵਸਥਾ ਵਾਲਾ ਆਪਣਾ ਦਿਮਾਗ ਹੈ ਉਹਦੇ ਉੱਤੇ ਕਿਤੇ ਨਾ ਕਿਤੇ ਇਹ ਚੀਜ਼ਾਂ ਦਾ ਅਸਰ ਪੈਂਦਾ ਤਾਂ ਕਰਕੇ ਆਪਾਂ ਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਆਪਣੇ ਜਿਹੜੇ ਨੋ ਨੇਮ ਬੋਰਡ ਹੋ ਗਏ ਸੜਕਾਂ ਦੇ ਦੁਆਲੇ ਜਿਹੜੇ ਬੋਰਡ ਲੱਗੇ ਹੋਏ ਆ ਘਰਾਂ ਦੇ ਬਾਹਰ ਆਪਣੀਆਂ ਨੇਮ ਪਲੇਟਸ ਨੇ ਉਹ ਸਾਰੀਆਂ ਪੰਜਾਬੀ ਦੇ ਵਿੱਚ ਹੀ ਹੋਣ ਤਾਂ ਕਿ ਆਪਣੇ ਜਿਹੜੇ ਜ ਆਉਣ ਵਾਲੀ ਪੀੜ੍ਹੀ ਹੈ ਆਪਾਂ ਉਹਨਾਂ ਨੂੰ ਪੰਜਾਬੀ ਭਾਸ਼ਾ ਦੇ ਨਾਲ ਜੋੜ ਸਕੀਏ ਤਾਂ ਉਹਨਾਂ ਨੂੰ ਇੱਕ ਉਹਨਾਂ ਦਾ ਮਾਇੰਡਸੈਟ ਇੱਦਾਂ ਨਾ ਉਹ ਸ਼ੁਰੂ ਤੋਂ ਲੈ ਕੇ ਪੈਦਾ ਹੋਣ ਵੀ ਜਿਹੜੀ ਅੰਗਰੇਜ਼ੀ ਹੈ ਜੇ ਤੁਹਾਨੂੰ ਅੰਗਰੇਜ਼ੀ ਆਉਂਦੀ ਹੋਵੇਗੀ ਤਾਂ ਹੀ ਤੁਹਾਡਾ ਕੀ ਹੈ ਮਤਲਬ ਤਾਂ ਹੀ ਤੁਸੀਂ ਇੰਟੈਲੀਜੈਂਟ ਹੋ ਠੀਕ ਹੈ ਉਹਨਾਂ ਨੂੰ ਮਤਲਬ ਇੱਦਾਂ ਕ ਉਹ ਤੁਲਨਾ ਨਾ ਕਰਨ ਅੰਗਰੇਜ਼ੀ ਪੰਜਾਬੀ ਇਹ ਕੀ ਹੈ ਇੱਕ ਭਾਸ਼ਾ ਹੀ ਹੈ ਤਾਂ ਆਪਣੀ ਮਾਤ ਭਾਸ਼ਾ ਕੀ ਹੈ ਪੰਜਾਬੀ ਤਾਂ ਆਪਣਾ ਰੁਝਾਨ ਆ ਜਿਹੜਾ ਇਹਦੇ ਵੱਲ ਹੀ ਝੁਕਾਓ ਆਪਣਾ ਵੱਧ ਹੋਣਾ ਚਾਹੀਦਾ ਧੰਨਵਾਦ